ਵੱਖ ਵੱਖ ਮੌਸਮ ਹੁੰਦੇ ਸਾਡੇ ਆਪਣੇ ਅਸੀਂ ਕੀ ਕਰਦੇ ਅੱਜ ਕੱਲ੍ਹ ਸਾਡੇ ਮੌਸਮ ਸਾਡਾ ਜਿਹੜਾ ਪਿਛੋਕੜ ਹੈ ਅਸੀਂ ਉਹ ਭੁੱਲਦੇ ਜਾ ਰਹੇ ਅੱਜ ਕੱਲ੍ਹ ਅਸੀਂ ਜੋ ਵੀ ਕਰ ਰਹੇ ਹਾਂ ਅੱਜ ਜਿਹੜੇ ਪੁਰਾਣੇ ਰੀਤੀ ਰਿਵਾਜ ਅਸੀਂ ਭੁੱਲਦੇ ਜਾ ਰਹੇ ਪਹਿਲਾਂ ਹੁੰਦਾ ਸੀ ਸਰਦੀਆਂ 'ਚ ਅਸੀਂ ਕੀ ਕਰਦੇ ਸੀ ਪੀਂਘਾਂ ਲੱਗਦੀਆਂ ਸੀ ਮੁ ਮੁਟਿਆਰਾਂ ਦੀਆਂ ਠੀਕ ਹੈ ਧੁੱਪੇ ਬੈਠਣਾ ਜਾਮਣਾਂ ਤੋੜਨੀਆਂ ਅੰਬੀਆਂ ਤੋੜਨੀਆਂ ਠੀਕ ਹੈ ਉਹ ਤੋਂ ਬਾਅਦ ਅਸੀਂ ਕੀ ਕਰਦੇ ਸੀ ਪਾਪੜ ਬਣਾਉਣੇ ਬੜੀਆਂ ਬਣਾਉਣੀਆਂ ਬਜ਼ੁਰਗ ਸਾਡੇ ਬੈਠੇ ਰਹਿੰਦੇ ਸੀਗੇ ਬੜੀਆਂ ਵੇਲਣੀਆਂ ਉਹ ਪਾਪੜ ਬਣਾਉਣੇ ਠੀਕ ਹੈ ਉਹ ਤੋਂ ਅੰਬ ਦਾ ਆਚਾਰ ਪਾਉਣਾ ਅੰਬੀਆਂ ਦਾ ਠੀਕ ਹੈ ਉਹ ਤੋਂ ਬਾਅਦ ਅਸੀਂ ਕੀ ਕਰਦੇ ਅੱਗੇ ਗਰਮੀ ਆ ਜਾਣੀ ਗਰਮੀ 'ਚ ਅਸੀਂ ਕੀ ਕਰਦੇ ਹੁੰਦੇ ਸੀ ਸਾਡੀਆਂ ਘੁਲਾੜੀਆਂ ਲੱਗਦੀਆਂ ਸੀ ਗੰਨੇ ਦਾ ਜੂਸ ਨਿਕਲਦਾ ਸੀ ਠੀਕ ਆ ਫੇਰ ਉਹ ਤੋਂ ਬਾਅਦ ਅਸੀਂ ਕੀ ਕਰਦੇ ਹੁੰਦੇ ਸੀਗੇ ਆਪਣਾ ਸਿੰਪਲ ਗੁੜ ਬਣਨਾ ਚਾਸ਼ਣੀ ਬਣਨੀ ਇਹ ਸਾਰਾ ਕੁਝ ਅਸੀਂ ਕਰਦੇ ਹੁੰਦੇ ਸੀਗੇ ਫੇਰ